ਹਾਂ ਮੈਂ ਚਿੱਤਰਕਾਰੀ ਦੀ ਕਲਾਸ ਵੀ ਲਗਾਈ ਹੈ ਅਤੇ ਵਰਕਸ਼ੋਪ ਵੀ ਲਗਾਈ ਹੈ ਮੈਂ ਚਿੱਤਰਕਾਰੀ ਦੀ ਕਲਾਸ ਲਗਾਈ ਹੈ ਮਤਲਬ ਸਾਡੇ ਕੋਲ ਡਰਾਇੰਗ ਵਿਸ਼ਾ ਹੁੰਦਾ ਸੀਗਾ ਮੈਂ ਸਕੂਲ 'ਚ ਪੜ੍ਹੀ ਹਾਂ ਮੈਂ ਬਹੁਤ ਵਧੀਆ ਚਿੱਤਰਕਾਰੀ ਕਰ ਲੈਂਦੀ ਹਾਂ ਆਪਣੇ ਹਿਸਾਬ ਨਾਲ ਮੈਂ ਆਪਣੇ ਮਨ ਦੇ ਜਿਹੜੇ ਭਾਵ ਹੁੰਦੇ ਆ ਉਹ ਚਿੱਤਰਾਂ ਰਾਹੀਂ ਬਿਆਨ ਕਰ ਸਕਦੀ ਹਾਂ ਅਤੇ ਵਰਕਸ਼ੋਪ ਲਈ ਤਾਂ ਬੱਚਿਆਂ ਨੂੰ ਸਕੂਲ ਦੇ ਹੀ ਬੱਚਿਆਂ ਨੂੰ ਸਮਝਾਇਆ ਗਿਆ ਰੰਗਾਂ ਬਾਰੇ ਸਮਝਾਇਆ ਚਿੱਤਰਕਾਰੀ ਕਿੱਦਾਂ ਕਰਦੇ ਇਹ ਸਮਝਾਇਆ ਅਤੇ ਅਸੀਂ ਗਰਮੀ ਦੀ ਛੁੱਟੀਆਂ 'ਚ ਸਮਰ ਕੈਂਪ ਵੀ ਲਗਾਇਆ ਸੀ ਜਿਸਦੇ ਵਿੱਚ ਚਿੱਤਰਕਾਰੀ ਤੋਂ ਹੀ ਸੰਬੰਧਿਤ ਟੋਪਿਕ ਰੱਖੇ ਗਏ ਸੀ ਅਤੇ ਉਸਦੇ ਅਨੁਭਵ ਤੋਂ ਮੈਨੂੰ ਇਹ ਸਿੱਖਿਆ ਕਿ ਜੇ ਆਪਾਂ ਬੱਚਿਆਂ ਨੂੰ ਕਿਸੇ ਚੀਜ਼ ਜਾਂ ਆਪਣੇ ਵੀ ਮਨ ਦੇ ਭਾਵ ਨੂੰ ਕਿਤੇ ਕਿਸੇ ਨੂੰ ਸਮਝਣ ਵਾਲੇ ਨੂੰ ਦੱਸਣਾ ਚਾਹੁੰਦੇ ਏ ਤਾਂ ਅਸੀਂ ਉਸਨੂੰ ਚਿੱਤਰ ਰਾਹੀਂ ਜ਼ਿਆਦਾ ਵਧੀਆ ਤਰੀਕੇ ਨਾਲ ਸਮਝਾ ਸਕਦੇ ਹਾਂ